ਗੁਰਦਾਸਪੁਰ ਜਿਲ੍ਹੇ ਵਿੱਚ ਕਈ ਤਰ੍ਹਾਂ ਦੀਆਂ ਜਾਤਾਂ ਕਬੀਲਿਆਂ ਭਾਸ਼ਾਵਾਂ ਸੱਭਿਆਚਾਰ ਨਾਲ ਸੰਬੰਧ ਲੋਕ ਰਹਿੰਦੇ ਹਨ ਜਿਹੜੇ ਕਿ ਭਾਵੇਂ ਹਰ ਇੱਕ ਜਾਤ ਹਰ ਕਬੀਲੇ ਦੀ ਆਪਣੀ ਅਲੱਗ ਹੀ ਭਾਸ਼ਾ ਹੈ ਅਲੱਗ ਹੀ ਰਹਿਣਾ ਪੀਣਾ ਖਾਣਾ ਸੱਭਿਆਚਾਰ ਹੈ ਪਰ ਫਿਰ ਵੀ ਉਹ ਇੱਕ ਦੂਜੇ ਦੇ ਨਾਲ ਇਕੱਠੇ ਰਹਿੰਦੇ ਹਨ ਇਕੱਠੇ ਧਾਰਮਿਕ ਅਤੇ ਹੋਰ ਕਈ ਤਰ੍ਹਾਂ ਦੇ ਤਿਉਹਾਰ ਇਕੱਠੇ ਹੀ ਮਨਾਉਂਦੇ ਹਨ ਅਤੇ ਇੱਕ ਦੂਜਿਆਂ ਦੇ ਹ ਅਲੱਗ ਅਲੱਗ ਜਾਤਾਂ ਹੋਣ ਦੇ ਬਾਵਜੂਦ ਵੀ ਹਰ ਇੱਕ ਹ ਹਰ ਇਕ ਆਪਣੇ ਤਿਉਹਾਰ ਅਤੇ ਵਿੱਚ ਅਸ ਦੂਜੀ ਜਾਤ ਦੇ ਜਾਂ ਦੂਜੇ ਕਬੀਲਿਆਂ ਦੇ ਨਾਲ ਖੁੱਲ੍ਹ ਕੇ ਮਨੋਰੰਜਨ ਕਰਦੀਆਂ ਹਨ ਅਤੇ ਇਸ ਕਰਕੇ ਕਿ ਮਤਲਬ ਕਿ ਅਲੱਗ ਅਲੱਗ ਇਸ ਵੈਸੇ ਵੀ ਸਾਡੇ ਪੰਜਾਬ 'ਚ ਕਹਿ ਲਓ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਹਿ ਲਓ ਕਿ ਜਿਸ ਤਰ੍ਹਾਂ ਕਿ ਧਾਰੀਵਾਲ ਜਾਂ ਉਹਦੇ ਆਸ ਪਾਸ ਇਲਾਕੇ ਵਿੱਚ ਜਿਵੇਂ ਆਪਾਂ ਕਹਿ ਲਓ ਕਿ ਮੁਸਲਮਾਨ ਜ਼ਿਆਦਾ ਰਹਿੰਦੇ ਹਨ ਜਿਨ੍ਹਾਂ ਦੀ ਜ਼ਿਆਦਾ ਮਾਂ ਬੋਲੀ ਉਹਨਾਂ ਦੀ ਇੱਕ ਤਰ੍ਹਾਂ ਉਹਨਾਂ ਦੇ ਵਿੱਚ ਉਰਦੂ ਦੇ ਕਈ ਅੱਖਰ ਹੁੰਦੇ ਲਫਜ਼ ਯੂ ਪ੍ਰਯੋਗ ਕਰਦੇ ਹਨ ਪਰ ਕਿਉਂਕਿ ਉਹਨਾਂ ਦੇ ਆਪਣੇ ਧਾਰਮਿਕ ਪੁਸਤਕ ਵੀ ਉਰਦੂ ਭਾਸ਼ਾ 'ਚ ਹੋਣ ਕਰਕੇ ਕਈ ਲਫਜ਼ ਵਗੈਰਾ ਉਹਨਾਂ ਦੀ ਭਾਸ਼ਾਈ ਸਾਡੀ ਆਮ ਪੰਜਾਬੀ ਭਾਸ਼ਾ ਤੋਂ ਅਲੱਗ ਹੈ ਪਰ ਫਿਰ ਵੀ ਉਹ ਸਾਡੀ ਪੰਜਾਬੀ ਬੋਲੀ ਇੱਕ ਮਿੱਠੀ ਇਤ ਇੱਕ ਸਰਲ ਬੋਲੀ ਹੈ ਜਿਸ ਵਿੱਚ ਅਸੀਂ ਕਈ ਕਈ ਸਾਡੀ ਪੰਜਾਬੀ ਮਾਂ ਬੋਲੀ ਨੇ ਵੀ ਕਈ ਤਰ੍ਹਾਂ ਦੇ ਉਰਦੂ ਵਰਡ ਅੱਖਰ ਆਪਣੀ ਭਾਸ਼ਾ ਦੇ ਵਿੱਚ ਉਹ ਉਹਨਾਂ ਆਪਾਂ ਬੜੀ ਸਰਲਤਾ ਦੇ ਨਾਲ ਪ੍ਰਯੋਗ ਹੋ ਗਏ ਹਨ